ਮੈਂ ਸੋਚ ਰਹੀ ਸੀਗੀ ਕਿ ਦੀਵਲੀ 'ਤੇ ਆਪਣੀ ਭੈਣ ਨੂੰ ਕੋਈ ਗਿਫਟ ਦੇਵਾਂ ਤਾਂ ਮੈਂ ਔਨਲਾਈਨ ਸਰਚ ਕੀਤਾ ਤਾਂ ਮੈਨੂੰ ਇੱਕ ਸੂਟ ਬਹੁਤ ਹੀ ਵਧੀਆ ਲੱਗਿਆ ਜਿਹਦਾ ਰੰਗ ਬਲੈਕ ਸੀਗਾ ਉਹਦੇ ਉੱਤੇ ਕਢਾਈ ਕੀਤੀ ਹੋਈ ਸੀਗੀ ਅਤੇ ਜਦੋਂ ਮੈਂ ਉਹ ਸੂਟ ਦੇਖਿਆ ਤਾਂ ਮੈਨੂੰ ਦੇਖਦੇ ਸਾਰ ਹੀ ਉਹ ਬਹੁਤ ਪਸੰਦ ਆ ਗਿਆ ਫਿਰ ਮੈਂ ਉਹਨੂੰ ਔਨਲਾਈਨ ਔਡਰ ਕਰ ਦਿੱਤਾ ਚਾਰ ਕੁ ਦਿਨਾਂ ਬਾਅਦ ਜਦੋਂ ਮੈਨੂੰ ਪ੍ਰੋਡਕਟ ਰਸੀਵ ਹੋਇਆ ਤਾਂ ਉਹ ਐਜ਼ ਇਟ ਇਜ਼ ਸੀਗਾ ਅਤੇ ਉਹਦੇ ਬਹੁਤ ਸੋਹਣਾ ਲੱਗ ਰਿਹਾ ਸੀਗਾ ਜਦੋਂ ਮੈਂ ਆਪਣੀ ਭੈਣ ਨੂੰ ਦਿਖਾਇਆ ਤਾਂ ਮੇਰੀ ਭੈਣ ਨੂੰ ਵੀ ਬਹੁਤ ਪਸੰਦ ਆਇਆ ਤਾਂ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਔਨਲਾਈਨ ਸ਼ੋਪਿੰਗ ਕਰਨ ਦਾ ਅਤੇ ਬਹੁਤ ਵਧੀਆ ਰਿਹਾ